ਮੈਨੂੰ ਕਿਸੇ ਜ਼ਰੂਰੀ ਕੰਮ ਤੋਂ ਬਠਿੰਡਾ ਜਾਣਾ ਪੈ ਗਿਆ ਸੀ ਮੈਂ ਉਸ ਕੰਮ ਲਈ ਟੈਕਸੀ ਬੁਲਵਾਈ ਸੀ ਤਾਂ ਉਸ ਜਦੋਂ ਮੈਂ ਟੈਕਸੀ ਵਿੱਚ ਬੈਠੀ ਤਾਂ ਪਹਿਲਾਂ ਦਾ ਕਚਰਾ ਉਹਦੇ ਵਿੱਚ ਉਵੇਂ ਹੀ ਸੀ ਟੈਕਸੀ ਵਾਲੇ ਟੈਕਸੀ ਦੀ ਬਿਲਕੁਲ ਸਫ਼ਾਈ ਨਹੀਂ ਕੀਤੀ ਸੀ ਉੱਪਰੋਂ ਮੈਂ ਉਹਨੂੰ ਕਿਹਾ ਕਿ ਤੂੰ ਸਾਫ਼ ਕਰ ਦੇ ਵੀ ਟੈਕਸੀ ਉਹ ਮੇਰੇ ਨਾਲ ਲੜਨ ਲੱਗ ਪਿਆ ਵੀ ਤੁਸੀਂ ਐਵੇਂ ਹੀ ਬੈਠ ਜਾਓ ਅਗਰ ਤੁਸੀਂ ਜਾਣਾ ਹੈ ਤਾਂ ਉੱਪਰੋਂ ਉਹ ਬਹੁਤ ਮਤਲਬ ਉਸਨੇ ਮਾਸਕ ਵੀ ਨਹੀਂ ਲਗਾਇਆ ਸੀ ਉੱਪਰੋਂ ਬਹੁਤ ਖੰਘ ਵੀ ਰਿਹਾ ਸੀ ਮੈਂ ਉਸਨੂੰ ਕਿਹਾ ਕਿ ਤੂੰ ਮਾਸਕ ਲਗਾ ਲੈ ਪਰ ਉਹ ਮੇਰੇ ਨਾਲ ਹੀ ਲੜਨ ਲੱਗ ਪਿਆ ਉਹ ਥੋੜ੍ਹਾ ਜਿਹਾ ਬਿਮਾਰ ਵੀ ਲੱਗ ਰਿਹਾ ਸੀ ਮੈਨੂੰ ਇਨਫੈਕਸ਼ਨ ਨਾ ਹੋ ਜਾਵੇ ਇਸ ਕਰਕੇ ਮੈਂ ਉਸ ਆਪਣੀ ਸੇਫਟੀ ਲਈ ਉਸ ਨੂੰ ਕਿਹਾ ਕਿ ਤੂੰ ਮਾਸਕ ਲਗਾ ਲੈ ਵੀ ਮੈਨੂੰ ਵੀ ਇਨਫੈਕਸ਼ਨ ਨਾ ਹੋ ਜਾਵੇ ਕਿਸੇ ਨੂੰ ਵੀ ਇਨਫੈਕਸ਼ਨ ਹੋ ਸਕਦੀ ਸੀ ਮੈਂ ਉਹ ਇਨਫੈਕਟ ਮੈਨੂੰ ਹੀ ਨਹੀਂ ਕਿਸੇ ਨੂੰ ਵੀ ਹੋ ਸਕਦੀ ਸੀ ਸੋ ਮੈਂ ਉਸਨੂੰ ਕਿਹਾ ਕਿ ਮਾਸਕ ਲਗਾ ਲੈ ਉਹ ਉੱਪਰੋਂ ਮੇਰੇ ਨਾਲ ਹੀ ਬੋਲਣ ਲੱਗ ਪਿਆ ਉਹ ਬਹੁਤ ਗਲਤ ਬੋਲਣ ਲੱਗ ਪਿਆ ਸੀ ਮੈਂ ਉਸਨੂੰ ਕਿਹਾ ਕਿ ਤੁਸ ਮੈਂ ਤੈਨੂੰ ਸਿਰਫ਼ ਸਾਫ਼ ਕਰਨ ਨੂੰ ਹੀ ਕਿਹਾ ਤੂੰ ਉੱਪਰੋਂ ਮੇਰੇ ਨਾਲ ਲੜਨ ਲੱਗ ਗਿਆ ਮੈਂ ਉਸਨੂੰ ਕਿਹਾ ਕਿ ਮੈਂ ਆਪਣੇ ਪਰਿਵਾਰ ਵਾਲੇ ਜਾਂ ਜਿੰਨੇ ਵੀ ਜਾਣ ਪਹਿਚਾਣ ਵਾਲੇ ਹੈ ਮੈਂ ਉਸ ਨਾਲ ਸਭ ਨੂੰ ਕਹੂੰਗੀ ਕਿ ਇਸ ਏਜੰਸੀ ਤੋਂ ਕੋਈ ਟੈਕਸੀ ਨਾ ਕਰਵਾਵੇ ਕੋਈ ਵੀ ਕੈਬ ਬੁਕ ਨਾ ਕਰਵਾਵੇ ਕਿਉਂਕਿ ਇਸ ਏਜੰਸੀ ਦੇ ਟੈਕਸੀ ਡਰਾਈਵਰ ਬਹੁਤ ਹੀ ਬੁਰੇ ਸੁਭਾਅ ਦੇ ਹਨ ਅਤੇ ਮੈਂ ਉਸਨੂੰ ਕਿਹਾ ਕਿ ਤੂੰ ਮੇਰੇ ਪੈਸੇ ਵਾਪਿਸ ਕਰ ਦੇ ਮੈਂ ਕਿਸੇ ਹੋਰ ਟੈਕਸੀ ਤੋਂ ਚਲੀ ਜਾਊਗੀ ਤਾਂ ਉੱਪਰੋਂ ਉਹ ਮੈਨੂੰ ਕਹਿੰਦਾ ਕਿ ਮੈਂ ਕੋਈ ਪੈਸੇ ਨਹੀਂ ਵਾਪਿਸ ਕਰਨੇ ਗੇ ਉਸਦੇ ਇਸ ਗੰਦੇ ਸੁਭਾਅ ਨੇ ਮੈਨੂੰ ਬਹੁਤ ਬੁਰਾ ਲੱਗਿਆ ਇਸ ਲਈ ਮੈਂ ਏਜੰਸੀ ਨੂੰ ਸ਼ਿਕਾਇਤ ਵੀ ਕੀਤੀ ਉਹ ਉੱਪਰੋਂ ਮੇਰੇ ਨਾਲ ਇੰਨਾ ਜ਼ਿਆਦਾ ਲੜਨ ਲੱਗ ਪਿਆ ਸੋ